ਵੱਖ ਵੱਖ ਰਾਜਾਂ ਵਿੱਚ ਆਪਣੀ ਬਾਈਕਿੰਗ ਯਾਤਰਾ ਦੌਰਾਨ ਮੈਨੂੰ ਵੱਖ ਵੱਖ ਖੇਤਰ ਦੇ ਬਾਈਕਰਾਂ ਨੂੰ ਮਿਲਣ ਅਤੇ ਉਹਨਾਂ ਨਾਲ ਸਵਾਰੀ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ ਯਾਤਰਾ ਦੇ ਸਭ ਤੋਂ ਵੱਧ ਫਲਦਾਇਕ ਪਹਿਲੂਆਂ ਵਿੱਚੋਂ ਇੱਕ ਬਾਈਕਰਾਂ ਵਿੱਚ ਭਾਈਚਾਰਾ ਅਤੇ ਦੋਸਤੀ ਦੀ ਮਜ਼ਬੂਤ ਭਾਵਨਾ ਸੀ ਭਾਵੇਂ ਉਹ ਕਿੱਥੋਂ ਦੇ ਕਿਉਂ ਹੀ ਨਾ ਹੋਣ ਹਰੇਕ ਰਾਜ ਵਿੱਚ ਮੈਂ ਸਥਾਨਕ ਬਾਈਕਿੰਗ ਭਾਈਚਾਰਿਆਂ ਨੂੰ ਮਿਲਿਆ ਜੋ ਹਮੇਸ਼ਾ ਸਵਾਗਤ ਕਰਦੇ ਸਨ ਕੁਝ ਸਵਾਰ ਮੈਨੂੰ ਸੁੰਦਰ ਰਿਸ਼ਤਿਆਂ ਰਾਹੀਂ ਮਾਰਗਦਰਸ਼ਨ ਕਰਦੇ ਸਨ ਅਤੇ ਮਨਪਸੰਦ ਪਿਟ ਸਟਾਪ ਸਾਂਝੇ ਕਰਦੇ ਸਨ ਅਤੇ ਸੜਕ ਦੀਆਂ ਸਥਿਤੀਆਂ ਬਾਰੇ ਸਲਾਹ ਦਿੰਦੇ ਹਨ ਇੱਕ ਵਾਰ ਪਹਾੜਾਂ ਵਿੱਚ ਲੰਘਦੇ ਸਮੇਂ ਮੈਨੂੰ ਕੋਲੋਂਰਾਡੋ ਦੇ ਬਾਈਕਰਾਂ ਦੇ ਇੱਕ ਸਮੂਹ ਨਾਲ ਮਿਲਿਆ ਜਿਹਨਾਂ ਨੂੰ ਨੇ ਮੈਨੂੰ ਕੁਛ ਮੁਸ਼ਕਲ ਖੇਤਰਾਂ ਵਿੱਚ ਨੈਗਟਿਵ ਕਰਨ ਦੀ ਮੇਰੀ ਮਦਦ ਕੀਤੀ ਖੇਤਰ ਬਾਰੇ ਉਹਨਾਂ ਦੇ ਗਿਆਨ ਅਤੇ ਸਹਾਇਤਾ ਕਰਨ ਦੀ ਉਹਨਾਂ ਦੀ ਇੱਛਾ ਨੇ ਮੇਰੀ ਸਵਾਰੀ ਨੂੰ ਬਹੁਤ ਸੁਚਾਰੂ ਬਣਾਇਆ

ਹੋਣ ਦੇ ਪਹਿਲੂਆਂ ਪਹਿਲਾਂ ਕੁਛ ਮੀਲ ਇਕੱਠੇ ਸਵਾਰੀ ਕਰਨ ਦੀ ਯੋਜਨਾ ਵੀ ਬਣਾਈ ਇਹ ਸ਼ਾਨਦਾਰ ਸੀ ਕਿ ਕਿਵੇਂ ਵੱਖ ਵੱਖ ਰਾਜਾਂ ਅਤੇ ਪਿਛੋਕੜਾਂ ਤੋਂ ਆਉਣ ਦੇ ਬਾਵਜੂਦ ਸਾਈਕਲਿੰਗ ਲਈ ਸਾਡਾ ਪਿਆਰ ਸਾਨੂੰ ਤੁਰੰਤ ਜੋੜਦਾ ਸੀ ਬੇਸ਼ੱਕ ਕੁਛ ਚੁਣੌਤੀਆਂ ਵੀ ਸਨ ਕੁਝ ਥਾਵਾਂ 'ਤੇ ਸਵਾਰੀ ਸੱਭਿਆਚਾਰ ਵੱਖਰਾ ਸੀ ਅਤੇ ਕੁਝ ਸਮੂਹ ਬਾਹਰੀ ਲੋਕਾਂ ਲਈ ਘੱਟ ਖੁੱਲ੍ਹੇ ਸਨ ਪਰ ਕੁੱਲ ਮਿਲਾ ਕੇ ਸਕਾਰਾਤਮਕ ਅਨੁਭਵ ਕਿਸੇ ਵੀ ਨਕਾਰਾਤਮਕ ਤੋਂ ਵੱਧ ਕਿਤੇ ਵੱਧ ਸਨ ਇਸ ਯਾਤਰਾ ਨੇ ਮੈਨੂੰ ਸਿਖਾਇਆ ਕਿ ਬਾਈਕਰ ਇੱਕ ਅਣਖੀ ਸਾਇਆ ਬੰਧਨ ਸਾਂਝਾ ਕਰਦੇ ਹਨ ਭਾਵੇਂ ਉਹ ਕਿਤੋਂ ਦੇ ਆਏ ਹੋਣ ਸੜਕ ਸਾਨੂੰ ਜੋੜਦੀ ਹੈ ਅਤੇ ਹਰ ਗੱਲਬਾਤ ਸਾਹਸ ਨੂੰ ਵਧਾਉਂਦੀ ਹੈ ਯਾਤਰਾ ਨੂੰ ਹੋਰ ਵੀ ਖਾਸ ਬਣਾਉਂਦੀ ਹੈ